ਇਹ ਸੰਦੇਸ਼ ਮੈਂ ਇਸ ਲਈ ਕਰ ਰਹੀ ਹਾਂ ਕਿ ਤੁਸੀਂ ਮੈਨੂੰ ਯਾਦ ਦਿਲਾਣਾ ਹੈ ਕਿ ਮੈਂ ਆਪਣੇ ਬੈਂਕ ਖਾਤੇ ਨੂੰ ਆਪਣੇ ਆਧਾਰ ਦੇ ਨਾਲ ਜੋੜਨਾ ਹੈ ਤਾਂ ਜੋ ਮੈਂ ਹਰ ਤਰ੍ਹਾਂ ਦੀ ਸਬਸਿਡੀ ਜੋ ਮੈਨੂੰ ਸਰਕਾਰ ਦਿੰਦੀ ਹੈ ਭਾਵੇਂ ਉਹ ਮੇਰੇ ਗੈਸ ਸਲੰਡਰ ਲਈ ਹੋਵੇ ਜਾਂ ਮੇਰੇ ਕਿਸੀ ਅਕਾਊਂਟ ਦੇ ਨਾਲ ਮਿਲਦੀ ਹੋਵੇ ਉਹ ਮੈਨੂੰ ਮਿਲ ਸਕੇ ਸਮੇਂ ਸਿਰ ਅਗਰ ਮੈਂ ਹਰ ਸਬਸਿਡੀ ਲੈਣਾ ਚਾਹੁੰਦੀ ਹਾਂ ਤਾਂ ਮੈਨੂੰ ਆਪਣਾ ਆਧਾਰ ਆਪਣੇ ਬੈਂਕ ਨਾਲ ਜੋੜਨਾ ਪਏਗਾ ਬੈਂਕ ਦੇ ਖਾਤੇ ਨਾਲ ਜੋੜਨਾ ਪਏਗਾ ਜੇ ਨਹੀਂ ਜੁੜੇਗਾ ਤਾਂ ਮੇਰੀ ਹਰ ਤਰ੍ਹਾਂ ਦੀ ਸਬਸਿਡੀ ਦਾ ਭੁਗਤਾਨ ਬੰਦ ਕਰ ਦੇਵੇਗੀ ਸਰਕਾਰ ਅਤੇ ਅਗਰ ਮੈਂ ਇਹਨਾਂ ਸਬਸਿਡੀ ਦੇ ਪੈਸੇ ਨੂੰ ਸਮੇਂ ਸਿਰ ਚਾਹੁੰਦੀ ਹਾਂ ਤਾਂ ਇਹ ਮੈਸੇਜ ਦੇ ਨਾਲ ਮੈਨੂੰ ਯਾਦ ਆਏਗਾ ਅਤੇ ਮੈਂ ਆਪਣਾ ਸਮੇਂ ਸਿਰ ਖਾਤਾ ਬੈਕ ਜੋੜ ਕੇ ਆਪਣੇ ਆਧਾਰ ਦੇ ਨਾਲ ਆਹ ਸਹੂਲਤ ਦਾ ਮਜ਼ਾ ਲਵਾਂਗੀ